ਹਾਂ ਸਾਡੇ ਭਾਈਚਾਰੇ ਵਿੱਚ ਸਰਕਾਰ ਮਤਲਬ ਕਿ ਸਕੂਲਾਂ ਜਾਂ ਅੰਗ ਸਕੂਲਾਂ ਜਾਂ ਆਂਗਣਵਾੜੀਆਂ ਵਿੱਚ ਜਾਗਰੂਕ ਕਰਨ ਲਈ ਬਹੁਤ ਸਾਰੇ ਪ੍ਰੋਗਰਾਮ ਲਾਉਂਦੇ ਹਨ ਜਾਂ ਪਿੰਡਾਂ ਵਿੱਚ ਵੀ ਆਉਂਦੇ ਹਨ ਤਾਂ ਉਹ ਜਾਗਰੂਕ ਕਰਨ ਲਈ ਪਿੰਡਾਂ ਵਿੱਚ ਅ ਮਤਲਬ ਕਿ ਬਿਮਾਰੀਆਂ ਲਈ ਬਿਮਾਰੀਆਂ ਬਾਰੇ ਦੱਸਦੇ ਹਨ ਕਿ ਆਹ ਕੁਝ ਕਰਨਾ ਚਾਹੀਦਾ ਜਾਂ ਉਹ ਕੁਛ ਕਰਨਾ ਚਾਹੀਦਾ ਹੈ ਨਾ ਜਾਗਰੂਕ ਕਰਨ ਲਈ ਬਹੁਤ ਸਾਰੇ ਕੈਂਪ ਲਾਉਂਦੇ ਹਨ ਪਿੰਡਾਂ ਵਿੱਚ ਆ ਕੇ ਜਾਂ ਧਰਮਸ਼ਾਲਾ ਜਾਂ ਆਂਗਣਵਾੜੀਆਂ ਜਾਂ ਅ ਕਿਸੇ ਵੀ ਅਹ ਖਾਲੀ ਪਿੰਡ ਦੀ ਸਾਂਝੀ ਜਗ੍ਹਾ 'ਤੇ ਕੈਂਪ ਲਵਾਉਂਦੇ ਹਨ ਜਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਜਾਂ ਜਾਂ ਬਿਮਾਰੀਆਂ ਬਾਰੇ ਜਾਂ ਕਿਸੇ ਵੀ ਡਾਕਟਰੀ ਦੇਖਭਾਲ ਲਈ ਹੈ ਨਾ ਡਾਕਟਰੀ ਜੋ ਬਿਮਾਰੀਆਂ ਤੋਂ ਬਚਾਉਣ ਲਈ ਸਾਨੂੰ ਜਾਗਰੂਕ ਕਰਦੇ ਹਨ ਉਹਨਾਂ ਬਾਰੇ ਕੈਂਪ ਲਗਾਏ ਜਾਂਦੇ ਹਨ ਅਤੇ ਇਹ ਸਾਡੇ ਪਿੰਡਾਂ ਵਿੱਚ ਮਹੀਨੇ ਵਿੱਚ ਦੋ ਤਿੰਨ ਵਾਰੀ ਆਉਂਦੇ ਹਨ ਜਾਗਰੂਕ ਕਰਨ ਲਈ ਕਹ ਜਨ ਸਾਡੇ ਪਿੰਡਾਂ ਜਾਂ ਸਕੂਲਾਂ ਵਿੱਚ ਲੋਕਾਂ ਨੂੰ ਜਾਗਰੂਕ ਜਾਂ ਬੱਚਿਆਂ ਵਗੈਰਾ ਜਾਂ ਕਿਸੇ ਨੂੰ ਵੀ ਡਾਕਟਰ ਬਿਮਾਰੀਆਂ ਤੋਂ ਜਾਗਰੂਕ ਕਰਨ ਲਈ ਕੈਂਪ ਜਾਂ ਨਾਟਕ ਵਗੈਰਾ ਕੁਛ ਵੀ ਉਹਨਾਂ 'ਤੇ ਸਪੀਚ ਵਗੈਰਾ ਦਿੰਦੇ ਹਨ ਕਿ ਜੋ ਕਿ ਲੋਕ ਉਹਨਾਂ ਨੂੰ ਸੁਣ ਕੇ ਜਾਂ ਨਾਟਕ ਦੇਖ ਕੇ ਜਾਂ ਅ ਜਾਗਰੂਕ ਹੋਣ ਅਤੇ ਬਿਮਾਰੀਆਂ ਤੋਂ ਬਚਣ ਇਹ ਕੈਂਪ ਮਹੀਨੇ ਵਿੱਚ ਦੀ ਦੋ ਤਿੰਨ ਵਾਰੀ ਲਗਾਏ ਜਾਂਦੇ ਹਨ ਹਰ ਪਿੰਡਾਂ ਵਿੱਚ ਇੱਕ ਡਾਕਟਰੀ ਟੀਮ ਜਾਂ ਸਰਕਾਰ ਦੁਆਰਾ ਭੇਜੇ ਗਏ ਭੇਜੀ ਗਈ ਟੀਮ ਪਿੰਡਾਂ ਵਿੱਚ ਜਾ ਕੇ ਕੈਂਪ ਲਗਾਉਂਦੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਹਨ